ਅੱਜ ਕੱਲ੍ਹ ਦੇ ਨੌਜਵਾਨ ਖੇਡਾਂ ਵਿੱਚ ਬਹੁਤ ਘੱਟ ਹਿੱਸਾ ਲੈਂਦੇ ਹਨ ਜਦਕਿ ਉਹਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਪਰ ਉਹ ਸਾਰਾ ਦਿਨ ਫੋਨਾਂ ਵਿੱਚ ਹੀ ਲੰਘਾ ਦਿੰਦੇ ਹਨ ਜਿਸ ਨਾਲ ਉਹ ਫ਼ੋਨਾਂ ਵਿੱਚ ਹੀ ਰੁੱਝੇ ਰਹਿੰਦੇ ਹਨ ਉਹ ਇੱਕ ਥਾਂ 'ਤੇ ਸਾਰਾ ਦਿਨ ਬੈਠ ਕੇ ਫੋਨ ਦੇਖਦੇ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਉਹਨਾਂ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਉਹਨਾਂ 'ਤੇ ਮੋਟਾਪਾ ਚੜ੍ਹਨ ਲੱਗ ਜਾਂਦਾ ਹੈ ਤਾਂ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਖੇਡਾਂ ਉੱਪਰ ਕੋਈ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ ਕੋਈ ਪ੍ਰੋਪਰ ਅਧਿਆਪਕ ਨਹੀਂ ਰੱਖੇ ਜਾਂਦੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਖੇਡਾਂ ਨੂੰ ਲੈ ਕੇ ਉਤਸ਼ਾਹਿਤ ਕਰੇ ਉਹਨਾਂ ਨੂੰ ਗਾਈਡ ਕਰੇ ਵੀ ਖੇਡਾਂ ਦੇ ਕੀ ਕੀ ਲਾਭ ਹੁੰਦੇ ਹਨ ਅਤੇ ਨਾਲ ਹੀ ਖੇਡਾਂ ਦਾ ਕੋਈ ਸਮਾਨ ਵੀ ਕੁਝ ਜ਼ਿਆਦਾ ਉਪਲਬਧ ਨਹੀਂ ਹੁੰਦਾ ਸਕੂਲਾਂ ਵਿੱਚ ਬੱਚੇ ਅਗਰ ਖੇਡਣਾ ਵੀ ਚਾਹੁਣ ਤਾਂ ਸਮਾਨ ਨਾ ਹੋਣ ਦੇ ਕਾਰਨ ਉਹ ਖੇਡ ਨਹੀਂ ਪਾਉਂਦੇ ਅਤੇ ਉਹਨਾਂ ਨੂੰ ਅਧਿਆਪਕ ਵੀ ਕੁਝ ਜ਼ਿਆਦਾ ਉਤਸ਼ਾਹਿਤ ਨਹੀਂ ਕਰਦੇ ਅਤੇ ਇਵੇਂ ਹੀ ਉਹਨਾਂ ਨੂੰ ਮਤਲਬ ਬੱਚੇ ਇੱਕ ਥਾਂ 'ਤੇ ਹੀ ਬੈਠ ਕੇ ਸਾਰਾ ਦਿਨ ਫੋਨ 'ਤੇ ਲੰਘਾ ਦਿੰਦੇ ਹਨ ਜਦ ਕਿ ਉਹਨਾਂ ਨੂੰ ਇਹ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਦਾ ਖੇਡਣਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਰਹਿਣ ਤੰਦਰੁਸਤ ਰਹਿਣ ਉਹਨਾਂ ਨੂੰ ਕੋਈ ਜ਼ਿਆਦਾ ਪ੍ਰਕਾਰ ਦੀਆਂ ਬਿਮਾਰੀਆਂ ਨਾ ਲੱਗਣ ਉਹ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਉਹ ਤੰਦਰੁਸਤ ਰਹਿਣ